ਸਾਡੇ ਭਾਈਚਾਰੇ ਦਾ ਧਾਰਮਿਕ ਆਗੂ ਸਿੱਖ ਧਰਮ ਹੈ ਉਸਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਹੈ ਸਿੱਖ ਧਰਮ ਵਿੱਚ ਦਸ ਗੁਰੂ ਹਨ ਜਿਵੇਂ ਗੁਰੂ ਗ੍ਰੰਥ ਸਹਿਬ ਵਿੱਚ ਉਨ੍ਹਾਂ ਦੀ ਬਾਣੀ ਦਰਜ ਹੈ ਅਤੇ ਸਾਡੇ ਪਰਿਵਾਰ ਦੇ ਮੈਂਬਰ ਗੁਰਬਾਣੀ ਨੂੰ ਜ਼ਿਆਦਾ ਸੁਣਦੇ ਹਨ ਅਤੇ ਉਹ ਇਸ ਵਿੱਚ ਉਸ ਨੂੰ ਸੁਣ ਕੇ ਉਸ ਦੀ ਆਗਿਆ ਕਰਦੇ ਹਨ ਬਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਸਾਨੂੰ ਅਲੱਗ ਅਲੱਗ ਧਰਮਾਂ ਨਾਲ ਵੀ ਜੋੜਨ ਦੀ ਪ੍ਰੇਰਨਾ ਮਿਲਦੀ ਹੈ ਸਾਨੂੰ ਹਰ ਇੱਕ ਨਾਲ ਮਿਲ ਕੇ ਰਹਿਣ ਦੀ ਆਗਿਆ ਦਿੱਤੀ ਜਾਂਦੀ ਹੈ ਸਾਰਿਆਂ ਨਾਲ ਹੱਕ ਦੀ ਕਮਾਈ ਕਰਨਾ ਵੀ ਸਾਨੂੰ ਬਾਣੀ ਤੋਂ ਸਿੱਖਣ ਨੂੰ ਹੀ ਮਿਲਦਾ ਹੈ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਸਾਨੂੰ ਸਾਡੀ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਸਾਡੇ ਸਿੱਖ ਧਰਮ ਆਉਣ ਨਾਲ ਸਾਡੇ ਜੀਵਨ ਵਿੱਚ ਇੱਕ ਦੂਜੇ ਪ੍ਰਤੀ ਭਾਵਨਾ ਵਧੀਆ ਰਹੀ ਹੈ ਇੱਕ ਦੂਜੇ ਪ੍ਰਤੀ ਈਰਖਾ ਨਹੀਂ ਰੱਖਦੇ ਸਾਡੇ ਸਿੱਖ ਧਰਮ ਵਿੱਚ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਸਾਨੂੰ ਸਾਰਿਆਂ ਨਾਲ ਮਿਲ ਵਰਤ ਕੇ ਰਹਿਣਾ ਚਾਹੀਦਾ ਹੈ ਇੱਕ ਦੂਜੇ ਪ੍ਰਤੀ ਕੋਈ ਵੀ ਈਰਖਾ ਨਹੀਂ ਰੱਖਣੀ ਚਾਹੀਦੀ ਸਾਰਿਆਂ ਨਾਲ ਮਿਲ ਕੇ ਵੰਡ ਛ ਵੰਡ ਛੱਕ ਕੇ ਵੰਡ ਕੇ ਛੱਕਣਾ ਚਾਹੀਦਾ ਹੈ ਹਰੇਕ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਸਿੱਖ ਧਰਮ ਸਾਡੇ ਜੀਵਨ ਵਿੱਚ ਮਹੱਤਵਪੂਰਨ ਸਿੱਖ ਧਰਮ ਵਿੱਚ ਬਹੁਤ ਸਾਰੇ ਲੋਕ ਹਨ ਬਹੁਤ ਸਾਰੇ ਲੋਕ ਸਿੱਖ ਧਰਮ ਨੂੰ ਪਸੰਦ ਕਰਦੇ ਹਨ ਸਿੱਖ ਧਰਮ ਵਿੱਚ ਰਹਿ ਕੇ ਬਹੁਤ ਲੋਕ ਨਿਤਨੇਮ ਕੋਈ ਪਾਠ ਕਰਦੇ ਹਨ ਸ਼ਾਮ ਨੂੰ ਸਵੇਰੇ ਟੈਮ ਉਹ ਪਾਠ ਕਰਦੇ ਹਨ ਬਹੁਤ ਸਾਰੇ ਲੋਕਾਂ ਦਾ ਅੰਮ੍ਰਿਤ ਛਕਿਆ ਹੁੰਦਾ ਹੈ ਉਹ ਆਪਣੇ ਸਿੱਖ ਧਰਮ ਦੀ ਇੱਜ਼ਤ ਕਰਦੇ ਹਨ